ਕਈ ਵਾਰ ਅਸੀਂ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਕਿਤੇ ਵੀ ਬਾਹਰ ਜਾਂਦੇ ਹਾਂ ਅਹੀਂ ਅਸੀਂ ਕਈ ਵਾਰ ਟਿਊ ਐਜ ਏ ਟਿਊਰਿਸਟ ਜਾਂਦੇ ਹਾਂ ਜਾਂ ਫਿਰ ਅਸੀਂ ਘੁੰਮਣ ਜਾਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਕਿ ਉੱਥੇ ਕਿਰਾਏ ਦੇ ਉੱਤੇ ਕਮਰਾ ਲੈਂਦੇ ਹਾਂ ਜਾਂ ਫਿਰ ਅਸੀਂ ਕਿਸੇ ਤੇ ਵੀ ਉੱਥੇ ਰਹਿਨ ਰਹਿੰਦੇ ਹਾਂ ਤਾਂ ਸਾਨੂੰ ਜੋ ਜੋ ਲੋੜੀਂਦੇ ਹੈ ਜਿਵੇਂ ਕਿ ਖਾਣ ਪੀਣ ਦੇ ਲਈ ਸਾਨੂੰ ਬਹੁਤ ਸਾਰਾ ਸਮਾਨ ਚਾਹੀਦਾ ਹੁੰਦਾ ਹੈ ਅਤੇ ਕਈ ਵਾਰ ਅਸੀਂ ਇਹੋ ਜਿਹੀ ਸੁੰਨਸਾਨ ਜਗ੍ਹਾ ਦੇ ਉੱਤੇ ਰਹਿਦੇ ਹਾਂ ਕਿ ਸਾਨੂੰ ਉਹ ਚੀਜਾਂ ਉੱਥੇ ਨਹੀਂ ਮਿਲਦੀਆਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਆਪਣੇ ਨਾਲ ਕੁਛ ਚੀਜ਼ਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਅਤੇ ਸਾਡੇ ਜਿਹੜਾ ਵੀ ਸਟੇਸ਼ਨ ਅਸੀਂ ਜਿਸ ਸਟੇਸ਼ਨ ਦੇ ਉੱਤੇ ਰੁਕਦੇ ਹਾਂ ਉੱਥੇ ਸਾਡੇ ਸੀਮਤ ਰਹਿਣ ਦੇ ਲਈ ਸਾਨੂੰ ਜੀਵਨ ਆਪਣਾ ਬਤੀਤ ਕਰਨ ਦੇ ਲਈ ਕੋਈ ਵੀ ਸਮਾਨ ਨਹੀਂ ਮਿਲਦਾ ਕਈ ਵਾਰ ਤਾਂ ਕੀ ਹੁੰਦਾ ਹੈ ਕਿ ਅਸੀਂ ਕਿਤੇ ਜਾ ਰਹੇ ਹੁੰਦੇ ਹਾਂ ਤਾਂ ਰਸਤੇ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਵਿੱਚ ਸਾਨੂੰ ਕੀ ਕਹਿ ਉੱਥੇ ਅਜਿਹੀ ਜਗ੍ਹਾ 'ਤੇ ਰੁਕਣਾ ਪੈਂਦਾ ਹੈ ਜਿੱਥੇ ਕਿ ਪਾਣੀ ਵੀ ਨਹੀਂ ਮਿਲਦਾ ਕਈ ਅਤੇ ਪਾਣੀ ਤੋਂ ਬਿਨਾਂ ਤਾਂ ਆਪਾਂ ਜਿਊਂਦੇ ਹੀ ਨਹੀਂ ਰਹਿ ਸਕਦੇ ਤਾਂ ਇਸ ਕਰਕੇ ਸਾਨੂੰ ਸਾਰਾ ਸਮਾਨ ਸਾਡਾ ਆਪਣਾ ਸਭ ਕੁਛ ਨਾਲ ਲਿਜਾਉਣਾ ਚਾਹੀਦਾ ਹੈ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਅਸੀਂ ਜਦੋਂ ਵੀ ਜਾਂਦੇ ਹਾਂ ਤਾਂ ਸਾਨੂੰ ਉੱਥੇ ਅਸ ਹਰ ਚੀਜ਼ ਨਹੀਂ ਕਈ ਵਾਰ ਮਿਲਦੀ ਸਾਨੂੰ ਕਈ ਵਾਰ ਸਾਡੇ ਮੁਤਾਬਿਕ ਭੋਜਨ ਵੀ ਨਹੀਂ ਮਿਲਦਾ ਅਸੀਂ ਆਟੇ ਵਾਲੀ ਰੋਟੀ ਖਾਂਦੇ ਹਾਂ ਤਾਂ ਉੱਥੇ ਕੀ